ਗੂਗਲ ਨਕਸ਼ੇ ਇਹ ਸਭ ਤੋਂ ਪ੍ਰਸਿੱਧ ਨੈਵੀਗੇਸ਼ਨ ਐਪਾਂ ਵਿੱਚੋਂ ਇੱਕ ਹੈ ਇਹ ਰੀਅਲ ਟਾਈਮ ਟਰੈਫਿਕ ਅਪਡੇਟ ਰੂਟ ਵਿਕਲਪ ਅਤੇ ਅੰਦਾਜਨ ਪਹੁੰਚਣ ਦੇ ਸਮੇਂ ਪ੍ਰਦਾਨ ਕਰਦਾ ਹੈ ਇਹ ਜਨਤਕ ਆਵਾਜਾਈ ਸਾਈਕਲਿੰਗ ਅਤੇ ਪੈਦਲ ਚੱਲਣ ਦੇ ਰੂਟਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕਰਦਾ ਹੈ ਇਸ ਨੂੰ ਬਹੁ ਪੱਖੀ ਬਹੁਮੁਖੀ ਬਣਾਉਂਦਾ ਹੈ ਸਥਾਨਕ ਕਾਰੋਬਾਰਾਂ ਜਾਣਕਾਰੀ ਸਮੀਖਿਆਵਾਂ ਅਤੇ ਸੜਕ ਦ੍ਰਿਸ਼ ਨਾਲ ਏਕੀਕਰਨ ਉਪਭੋਗਤਾਵਾਂ ਨੂੰ ਨਵੀਆਂ ਥਾਵਾਂ ਖੋਜਣ ਵਿੱਚ ਮਦਦ ਕਰਕੇ ਅਨੁਭਵ ਨੂੰ ਭਰਪੂਰ ਬਣਾਉਂਦਾ ਹੈ ਧੰਨਵਾਦ